ਹੈਲੋ ਹਾਂਜੀ ਪਲਵੀ ਬੋਲ ਰਹੀ ਹਾਂ ਹਾਂਜੀ ਹਾਂਜੀ ਮੇਰੀ ਮੇਰਾ ਮੰਨਣਾ ਵਾ ਕਿ ਬੇਅੰਤ ਕਾਲਜ ਬੈਸਟ ਆ ਜੇ ਤੁਸੀਂ ਅੱਗੋਂ ਆਪਣੀ ਸਟੱਡੀ ਨੂੰ ਕੋਂਟੀਨਿਊ ਕਰਨਾ ਚਾਹੁੰਦੇ ਹੋ ਤਾਂ ਹਾਂਜੀ ਕਿਉਂਕਿ ਉੱਥੇ ਤੁਹਾਨੂੰ ਸਾਰੀਆਂ ਫੈਸਿਲਿਟੀਜ਼ ਮਿਲਣਗੀਆਂ ਜਿਵੇਂ ਕਿ ਵਜ਼ੀਫਾ ਵਗੈਰਾ ਵੀ ਹੈ ਨਾ ਉੱਥੇ ਸਾਰਾ ਕੁਝ ਹੁੰਦਾ ਆ ਉੱਥੋਂ ਦਾ ਸਟੱਡੀ ਜਿਹੜੇ ਆ ਟੀਚਰ ਬਹੁਤ ਵਧੀਆ ਨੇ ਵੈਸੇ ਵੀ ਤਾਂ ਉੱਥੇ ਬਹੁਤ ਵਧੀਆ ਆ ਪੜ੍ਹਾਈ ਦੇ ਪੜ੍ਹਾਈ ਵੱਲੋਂ ਵੀ ਅਤੇ ਵੈਸੇ ਵੀ ਨਹੀਂ ਨਹੀਂ ਫੀਸ ਦਾ ਕੋਈ ਇਸ਼ੂ ਨਹੀਂ ਆਪਾਂ ਇੰਸਟਾਲਮੈਂਟ ਨਾਲ ਵੀ ਫੀਸ ਦੇ ਸਕਦੇ ਹਾਂ ਅਤੇ ਬਾਕੀ ਗੱਲ ਰਹੀ ਸਕੋਲਰਸ਼ਿਪ ਦੀ ਉਹ ਵੀ ਮਤਲਬ ਵਧੀਆ ਆ ਸਕੋਲਰਸ਼ਿਪ ਤੁਹਾਨੂੰ ਜ਼ਰੂਰ ਮਿਲਦੀ ਹੈ ਉੱਥੇ ਸਟੱਡੀ ਦੇ ਬੇਸ 'ਤੇ ਜੇ ਤੁਸੀਂ ਅੱਛਾ ਪੜ੍ਹੋਗੇ ਤਾਂ ਉਹ ਸਕੋਲਰਸ਼ਿਪ ਹੋਰ ਵੀ ਵਧੀਆ ਹੋਊਗੀ ਹਾਂਜੀ ਹਾਂਜੀ ਮੈਂ ਜ਼ਰੂਰ ਚੱਲਾਂਗੀ ਤੁਹਾਡੇ ਨਾਲ ਠੀਕ ਆ ਅਸੀਂ ਇਕੱਠੇ ਚੱਲਾਂਗੇ ਓਕੇ ਬਾਏ ਟੇਕ ਕੇਅਰ